ਪੰਜਾਬੀ ਭਾਸ਼ਾ ਸਾਡੇ ਰਾਜ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਪ੍ਰਮੁੱਖ ਭਾਸ਼ਾ ਹੈ ਅਤੇ ਇਹ ਸਾਡੀ ਮਾਂ ਬੋਲੀ ਵੀ ਹੈ ਪੰਜਾਬੀ ਭਾਸ਼ਾ ਜਿਹੜੀ ਹੈਗੀ ਹੈ ਸਿੱਖਿਆ ਪ੍ਰਣਾਲੀ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਕਿਉਂਕਿ ਜਿਹੜੇ ਪੰਜਾਬ ਦੇ ਸਕੂਲ ਹਨ ਮੇਨ ਹੈ ਨਾ ਗੌਰਮੈਂਟ ਸਕੂਲ ਹਨ ਉਹਨਾਂ ਦੇ ਵਿੱਚ ਜਿਹੜਾ ਸਿੱਖਿਆ ਦਾ ਮਾਧਿਅਮ ਹੈ ਉਹ ਪੰਜਾਬੀ ਹੀ ਹੈ ਜੇ ਆਪਾਂ ਸ਼ੁਰੂ ਤੋਂ ਹੀ ਬੱਚੇ ਨੂੰ ਇੰਗਲਿਸ਼ ਮਾਧਿਅਮ ਦੇ ਵਿੱਚ ਪੜਾਵਾਂਗੇ ਤਾਂ ਬੱਚਾ ਆਪਣੀ ਮਾਂ ਬੋਲੀ ਤੋਂ ਵਾਂਝਾ ਹੋ ਜਾਵੇਗਾ ਉਸਨੂੰ ਆਪਣੀ ਮਾਂ ਬੋਲੀ ਬਾਰੇ ਕੁਝ ਪਤਾ ਹੀ ਨਹੀਂ ਚੱਲੇਗਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀਗੀਆਂ ਸੱਭਿਆਚਾਰਕ ਚੀਜ਼ਾਂ ਸੀਗੀਆਂ ਉਹਨਾਂ ਨੂੰ ਉਹ ਚੀਜ਼ਾਂ ਦੇ ਨਾਮ ਵੀ ਨਹੀਂ ਪਤਾ ਹੁਣ ਵੀ ਜੇ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੋਣਗੇ ਜਿਨਾਂ ਨੂੰ ਪੁਰਾਣੇ ਜਿਹੜੇ ਆਪਾਂ ਘਰਾਂ ਦੇ ਵਿੱਚ ਭਾਂਡੇ ਜਾਂ ਕੁਝ ਵੀ ਯੂਜ਼ ਕਰਦੇ ਸੀਗੇ ਉਹਨਾਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਪਤਾ ਇਸ ਕਰਕੇ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਸਿੱਖਿਆ ਪ੍ਰਣਾਲੀ ਦੇ ਵਿੱਚ ਬਹੁਤ ਜ਼ਰੂਰੀ ਹੈ ਇਹ ਜ਼ਰੂਰ ਸ਼ਾਮਿਲ ਹੋਣੀ ਚਾਹੀਦੀ ਹੈ ਸਕੂਲਾਂ ਦੇ ਵਿੱਚ ਵੀ ਇਹ ਪ੍ਰਮੁੱਖ ਭਾਸ਼ਾ ਦੇ ਵਜੋਂ ਸ਼ਾਮਿਲ ਹੋਣੀ ਚਾਹੀਦੀ ਹੈ ਅਤੇ ਇਹ ਬਹੁਤ ਹੀ ਮੇਨ ਰੋਲ ਅਦਾ ਕਰੇਗੀ ਪੰਜਾਬੀ ਭਾਸ਼ਾ ਨੂੰ ਬਚਾਉਣ ਦੇ ਲਈ